ਬੀਮੇ ਨੂੰ ਲੈ ਕੇ ਲੋਕਾਂ ਦੇ ਵਿੱਚ ਬਹੁਤ ਹੀ ਗਲਤ ਧਾਰਨਾਵਾਂ ਬਣੀਆਂ ਹੋਈਆਂ ਹਨ ਜਦ ਕਿ ਬੀਮਾ ਇੱਕ ਬਹੁਤ ਹੀ ਫਾਇਦੇ ਵਾਲਾ ਸੌਦਾ ਹੈ ਲੋਕਾਂ ਦੇ ਹਿਸਾਬ ਨਾਲ ਬੀਮਾ ਇੱਕ ਵਿਅਰਥ ਖਰਚਾ ਹੈ ਪਰ ਜਦੋਂ ਕਿਸੇ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਤੇ ਉਸ ਦੀ ਸਾਰਾ ਜੋ ਵੀ ਜਮਾ ਪੂੰਜੀ ਹੁੰਦੀ ਹੈ ਉਹ ਲੱਗ ਜਾਂਦੀ ਹੈ ਫਿਰ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਬੀਮਾ ਕਰਾ ਲੈਣਾ ਚਾਹੀਦਾ ਸੀ ਇਹ ਵਿਅਰਥ ਖਰਚਾ ਨਹੀਂ ਹੈ ਕੁਝ ਕੁ ਲੋਕਾਂ ਨੂੰ ਨੌਕਰੀ ਵੱਲੋਂ ਵੀ ਬੀਮਾ ਮਿਲਿਆ ਹੁੰਦਾ ਹੈ ਜੋ ਕਿ ਜਿਆਦਾ ਫਾਇਦੇਮੰਦ ਨਹੀਂ ਹੁੰਦਾ ਉਸ ਦੇ ਵਿੱਚ ਜਿਆਦਾ ਫਾਇਦਾ ਨਹੀਂ ਹੁੰਦਾ ਹਰ ਵਿਅਕਤੀ ਨੂੰ ਆਪਣਾ ਬੀਮਾ ਖੁਦ ਤੋਂ ਕਰਵਾਉਣਾ ਚਾਹੀਦਾ ਹੈ ਅਗਰ ਵਿਅਕਤੀ ਦੀ ਨੌਕਰੀ ਛੁੱਟ ਜਾਵੇ ਤੇ ਉਸ ਦੇ ਨਾਲ ਉਹ ਬੀਮਾਂ ਕਵਰ ਨਹੀਂ ਹੁੰਦਾ ਕੁਝ ਕ ਲੋਕਾਂ ਨੂੰ ਇਹ ਵੀ ਧਾਰਨਾ ਹੈ ਕਿ ਜਵਾਨ ਲੋਕਾਂ ਨੂੰ ਬੀਮੇ ਦੀ ਕੋਈ ਲੋੜ ਨਹੀਂ ਹੁੰਦੀ ਜਦ ਕਿ ਜਵਾਨ ਵਿਅਕਤੀ ਵੀ ਕਦੇ ਨਾ ਕਦੇ ਬਿਮਾਰ ਪੈ ਜਾਂਦਾ ਹੈ ਬਿਮਾਰੀ ਕਦੇ ਵੀ ਦੱਸ ਕੇ ਨਹੀਂ ਆਉਂਦੀ ਇਸ ਲਈ ਬੀਮਾ ਇੱਕ ਬਹੁਤ ਵਧੀਆ ਚੀਜ਼ ਹੈ ਬੀਮਾ ਲੈਣ ਮਤਲਬ ਹੈ ਕਿ ਮੈਂ ਆਪਣੀ ਆਪ ਨੂੰ ਹਰ ਪਾਸਿਓ ਸੁਰਖਸ਼ਿਤ ਕਰ ਲਿਆ ਹੈ ਬੀਮਾ ਇੱਕ ਸੁਰੱਖਿਆ ਹੈ ਨਾ ਕਿ ਇਕ ਖਰਚਾ